ਸਾਡੇ ਖੇਤਰ ਵਿੱਚ ਮਨੋਰੰਜਨ ਦੀਆਂ ਵੱਖ ਵੱਖ ਤਰੀਕੇ ਦੀਆਂ ਗਤੀਵਿਧੀਆਂ ਹਨ ਸਭ ਤੋਂ ਆਮ ਤੌਰ 'ਤੇ ਜਿਹੜਾ ਸਾਡੇ ਖੇਤਰ ਵਿੱਚ ਮਨੋਰੰਜਨ ਦੀ ਗਤੀਵਿਧੀ ਹੈ ਉਹ ਹੈ ਪਾਰਕ ਜਿੱਥੇ ਸਾਨੂੰ ਥਾਂ ਥਾਂ 'ਤੇ ਪਾਰਕ ਮਿਲ ਜਾਂਦੇ ਹਨ ਭਾਵੇਂ ਛੋਟੇ ਹੋਣ ਭਾਵੇਂ ਉਹ ਵੱਡੇ ਹੋਣ ਅਤੇ ਜਿਹੜੀ ਫੈਮਲੀਜ਼ ਆ ਉਹ ਪਾਰਕ ਵਿੱਚ ਜਾਂਦੇ ਹਨ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਭਰਾਵਾਂ ਨੂੰ ਲੈ ਕੇ ਅਤੇ ਉੱਥੇ ਜਾ ਕੇ ਉਹ ਕਈ ਵਾਰੀ ਸੈਰ ਕਰਦੇ ਹਨ ਖੇਡਦੇ ਹਨ ਅਤੇ ਇਸ ਤਰੀਕੇ ਨਾਲ ਵੀ ਉਹ ਇਕੱਠੇ ਹੁੰਦੇ ਹਨ ਅਤੇ ਦੂਜਾ ਜਿਹੜਾ ਆਮ ਮਨੋਰੰਜਨ ਦਾ ਗਤੀਵਿਧੀ ਹੈ ਉਹ ਹੈ ਸਾਡੇ ਥੀਏਟਰ ਜਿੱਥੇ ਆਪਾਂ ਮੂਵੀ ਦੇਖਦੇ ਹਨ ਜਿਸ ਕਰਕੇ ਜਿਹੜੇ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਅਤੇ ਉਹ ਰਲ ਮਿਲ ਕੇ ਬਾਅਦ ਵਿੱਚ ਕਦੇ ਕ ਵਾਰੀ ਮੌਲ ਚਲੇ ਜਾਂਦੇ ਹਨ ਜਿਹੜੇ ਸਾਡੇ ਤੀਜਾ ਮਨੋਰੰਜਨ ਦੀ ਗਤੀਵਿਧੀ ਆ ਗਈ ਹੈ ਮੌਲਾਂ ਵਿੱਚ ਹੁਣ ਵੱਖ ਵੱਖ ਤਰੀਕੇ ਦੀਆਂ ਸ਼ੋਪਸ ਹੁੰਦੀਆਂ ਹਨ ਉਹ ਉੱਥੇ ਖੇਡਦੇ ਹਨ ਸ਼ੋਪਿੰਗ ਕਰਦੇ ਹਨ ਘੁੰਮਦੇ ਹਨ ਅਤੇ ਸਾਡੇ ਹੁਣ

ਖੇਤਰ ਵਿੱਚ ਕਾਫੀ ਸਾਰੇ ਜਿਵੇਂ ਕਿ ਵੰਡਰ ਲੈਂਡ ਜਿਵੇਂ ਕਿ ਸਾਡੇ ਆਰਕਟ ਗੇਮਸ ਵੀ ਆ ਜਾਂਦੇ ਹਨ ਜਿੱਥੇ ਸਾਰੇ ਰਲ ਮਿਲ ਕੇ ਜਿਹੜੇ ਆ ਉਹ ਮੋਸ ਉੱਥੇ ਮੋਸਟਲੀ ਵੱਡੇ ਬੱਚੇ ਜਾਂਦੇ ਹਨ ਉਹ ਸਾਰੇ ਰਲ ਮਿਲ ਕੇ ਆਪਣਾ ਕ ਵੋਟਰ ਪਾਰਕ ਵਗੈਰਾ ਵਿੱਚ ਖੇਡਦੇ ਹਨ ਜਾਂ ਫਿਰ ਬੋਲਿੰਗ ਵਗੈਰਾ ਕਰਦੇ ਹਨ ਜਾਂ ਫਿਰ ਜਿਹੜੇ ਵੱਡਿਆਂ ਬੱਚਿਆਂ ਦੀ ਗੇਮਜ ਹੁੰਦੀਆਂ ਹਨ ਜਿਵੇਂ ਕਿ ਪੰਚ ਬੈਗ ਬੋਲਿੰਗ ਉਹ ਸਾਰਾ ਕੁਛ ਖੇਡਦੇ ਹਨ ਅਤੇ ਇਹ ਮੈਨੂੰ ਲੱਗਦਾ ਹੈ ਇਸ ਤਰੀਕੇ ਨਾਲ ਸਾਰੇ ਇਕੱਠੇ ਹੁੰਦੇ ਹਨ ਸਾਰੇ ਰਲ ਮਿਲ ਕੇ ਖੇਡਦੇ ਹਨ ਇੱਕ ਦੂਜੇ ਨਾਲ ਸਮਾਂ ਬਤੀਤ ਕਰਦੇ ਹਨ ਅਤੇ ਇੱਕ ਦੂਜੇ ਨਾਲ ਨੇੜੇ ਜਿਹੜਾ ਕਨੈਕਸ਼ਨ ਆ ਉਹ ਕਲੋਜ਼ ਹੁੰਦਾ ਹੈ